ਹੈਲੋ

ਹਾਂਜੀ ਹਾਂਜੀ ਹਾਂਜੀ ਮੈਨੂੰ ਵੀ ਆਈ ਸੀ ਉਹਨਾਂ ਦੀ ਕੌਲ ਕਿ ਉਹਨਾਂ ਦੇ ਕੋਈ ਜਾਣਕਾਰ ਆ ਰਹੇ ਆ ਹਾਂਜੀ ਹਾਂਜੀ ਹਾਂਜੀ ਮੈਮ ਬਹੁਤ ਵਧੀਆ ਮੈਮ ਮੈਮ ਜਿਵੇਂ ਹੁਣ ਜੂਨ ਦਾ ਮਹੀਨਾ ਇਸ ਟਾਈਮ ਇੱਥੇ ਹੁਣ ਬਹੁਤ ਜ਼ਿਆਦਾ ਗਰਮੀ ਹੈਗੀ ਹੈ ਦੇ ਹਿਸਾਬ ਨਾਲ ਅਤੇ ਬਾਕੀ ਬਾਕੀ ਉਂ ਕੁਛ ਨਹੀਂ ਹੈਗਾ ਮੈਮ ਵਧੀਆ ਹੈਗਾ ਆਪਾਂ ਇੱਥੇ ਵਧੀਆ ਰਹਿ ਸਕਦੇ ਹੈਗੇ ਹਾਂ ਬੈਠ ਕੇ ਗਰਮੀ ਦੇ ਮੌਸਮ ਥੋੜ੍ਹਾ ਪਾਣੀ ਦਾ ਬਦਲਾਵ ਹੋ ਜਾਂਦਾ ਹੈਗਾ ਤਾਂ ਤਾਂ ਦਿੱਕਤ ਆ ਜਾਂਦੀ ਨਹੀਂ ਤਾਂ ਵਧੀਆ ਹੈ ਮੈਡਮ ਕੋਈ ਇੱਥੇ ਦਿੱਕਤ ਨਹੀਂ ਨਹੀਂ ਨਹੀਂ ਮੈਡਮ ਆਪਣੇ ਕੋਲਜ ਵਧੀਆ ਸਾਰਾ ਹਾਂਜੀ ਹਾਂਜੀ ਮੈਮ ਨਹੀਂ ਨਹੀਂ ਨਹੀਂ ਮੈਡਮ ਕੋਈ ਨਹੀਂ ਆਪਣੇ ਕਾਲਜ 'ਚ ਵਧੀਆ ਆਰ ਔ ਊਰੋ ਲੱਗੇ ਹੋਏ ਆ ਪਾਣੀ ਦੀ ਕੋਈ ਦਿੱਕਤ ਨਹੀਂ ਆਵੇਗੀ ਤੁਹਾਨੂੰ ਰਹਿਣ 'ਚ ਵੀ ਕੋਈ ਦਿੱਕਤ ਨਹੀਂ ਆਵੇਗੀ ਵਧੀਆ ਰੂਮ ਬਣੇ ਹੋਏ ਆ ਉੱਥੇ ਕੋਈ ਦਿੱਕਤ ਨਹੀਂ ਹੈਗੀ ਤੁਸੀਂ ਕਦੋਂ ਆਉਣਾ ਏ ਅੱਛਾ ਅਤੇ ਤੁਹਾਡੇ ਹੋਸਟਲ ਦਾ ਹੋ ਗਿਆ ਜੀ ਹਾਂ ਹਾਂ ਤੁਸੀਂ ਕੋਈ ਗੱਲ ਨਹੀਂ ਤੁਸੀਂ ਆ ਜਿਓ ਹਾਂਜੀ ਹਾਂਜੀ ਠੀਕ ਹੈ ਮੈਮ ਠੀਕ ਹੈ ਜੀ